ਹਾਂ ਸਾਡੇ ਪਿੰਡ 'ਚ ਕਬਜ਼ ਦੇ ਇਲਾਜ ਲਈ ਸਭ ਤੋਂ ਪਹਿਲਾ ਨੁਸਖਾ ਹੈ ਕਿ ਤੁਸੀਂ ਅੱਜ ਗਰਮ ਦੁੱਧ ਲੈ ਲਉ ਗਰਮ ਦੁੱਧ ਦੇ ਵਿੱਚ ਦੇਸੀ ਘੀ ਪਾ ਕੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪੀ ਲਉ ਅਤੇ ਇਹ ਨੁਸਖਾ ਬੱਚੇ ਵੀ ਲੈ ਸਕਦੇ ਨੇ ਕੋਈ ਵੀ ਹੋ ਗਿਆ ਵਿਅਕਤੀ ਜੇ ਤੁਹਾਨੂੰ ਕਬਜ਼ ਹੈ ਤਾਂ ਤੁਸੀਂ ਗਰਮ ਦੁੱਧ ਦੇ ਵਿੱਚ ਦੇਸੀ ਘੀ ਪਾ ਕੇ ਪੀ ਲਉਗੇ ਤਾਂ ਇਸ ਨਾਲ ਤੁਹਾਡੀ ਜਿਹੜੀ ਕਬਜ਼ ਹੈ ਨਾ ਉਹ ਠੀਕ ਹੋ ਜਾਵੇਗੀ ਇਸ ਤੋਂ ਇਲਾਵਾ ਹੋਰ ਨੁਸਖਾ ਹੈ ਕਿ ਤੁਸੀਂ ਜ਼ੀਰਾ ਹੋ ਗਿਆ ਅਜਵਾਇਨ ਹੋ ਗਈ ਇਹਨੂੰ ਚੰਗੀ ਤਰ੍ਹਾਂ ਭੁੰਨ ਲਉ ਭੁੰਨ ਕੇ ਇਹਨੂੰ ਗਰਮ ਪਾਣੀ ਦੇ ਵਿੱਚ ਪਾ ਕੇ ਪੀ ਲਉ ਤਾਂ ਵੀ ਤੁਹਾਡੀ ਕਬਜ਼ ਠੀਕ ਹੋ ਸਕਦੀ ਹੈ ਇਸ ਤੋਂ ਇਲਾਵਾ ਜੇ ਤੁਹਾਨੂੰ ਕਾਫੀ ਦਿਨਾਂ ਤੋਂ ਕਬਜ਼ ਬਹੁਤ ਪੁਰਾਣੀ ਹੈ ਫਿਰ ਕੀ ਕੀਤਾ ਜਾਂਦਾ ਸਾਡੇ ਪਿੰਡ 'ਚ ਉਹਨੂੰ ਗਰਮ ਦੁੱਧ ਲੈ ਕੇ ਉਹਦੇ ਵਿੱਚ ਅਰੰਡੀ ਦਾ ਤੇਲ ਪਾ ਕੇ ਰਾਤ ਨੂੰ ਸੋਣ ਤੋਂ ਪਹਿਲਾਂ ਖਾਣਾ ਖਾਣ ਤੋਂ ਬਾਅਦ ਪੀ ਲਉ ਅਤੇ ਦੁੱਧ ਨਾਲ ਹਰ ਕਿਸਮ ਦੀ ਕੋਈ ਵੀ ਕਬਜ਼ ਹੈ ਉਹ ਠੀਕ ਹੋ ਜਾਂਦੀ ਹੈ ਇਹਨੂੰ ਸਿਰਫ ਵੱਡੇ ਹੀ ਯੂਜ ਕਰ ਸਕਦੇ ਨੇ ਬਾਕੀ ਜਿਹੜੇ ਨੁਸਖੇ ਹੈ ਉਹ ਬੱਚੇ ਵੀ ਕੇ ਲੈ ਸਕਦੇ ਨੇ ਅਤੇ ਬਜ਼ੁਰਗ ਵੀ ਲੈ ਸਕਦੇ ਨੇ